ਜਦੋਂ ਕੋਈ ਵਿਅਕਤੀ ਗਾਉਣਾ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮੇਰੀ ਉਸ ਨੂੰ ਇਹ ਹੀ ਸਲਾਹ ਹੈ ਕਿ ਉਹ ਸਭ ਤੋਂ ਪਹਿਲਾਂ ਰਿਆਜ਼ ਕਰੇ ਕਿਉਂਕਿ ਇੰਗਲਿਸ਼ ਵਿੱਚ ਇਹ ਵੀ ਕਹਿੰਦੇ ਹਨ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਸਭ ਤੋਂ ਪਹਿਲਾਂ ਰਿਆਜ਼ ਹੀ ਜ਼ਰੂਰੀ ਹੈ ਰਿਆਜ਼ ਹੀ ਜ਼ਰੂਰੀ ਹੈ ਅਤੇ ਰਿਆਜ਼ ਹੀ ਜ਼ਰੂਰੀ ਹੈ ਅਤੇ ਸਭ ਤੋਂ ਪਹਿਲਾਂ ਉਸ ਦੇ ਨਾਲ ਨਾਲ ਚੰਗਾ ਸੁਣਨਾ ਵੀ ਬਹੁਤ ਜ਼ਰੂਰੀ ਹੈ ਚੰਗਾ ਸੁਣੋਗੇ ਚੰਗਾ ਦਿਮਾਗ 'ਚ ਪਵੇਗਾ ਅਤੇ ਫਿਰ ਚੰਗਾ ਹੀ ਆਪਣੇ ਦਿਮਾਗ 'ਚ ਪੈ ਕੇ ਅਤੇ ਉਹਹੀ ਆਪਣੇ ਬੋਲਾਂ ਰਾਹੀਂ ਬਾਹਰ ਨਿਕਲੇਗਾ ਕਿਉਂਕਿ ਅੱਜ ਕੱਲ੍ਹ ਦੇ ਗੀਤ ਜਿਵੇਂ ਕਿ ਪੋਪ ਮਿਊਜਿਕ ਹੈ ਪੋਪ ਮਿਊਜਿਕ ਨੂੰ ਮੈਂ ਮਾੜਾ ਨਹੀਂ ਕਹਿੰਦਾ ਪਰ ਉਹਨਾਂ ਵਿੱਚ ਕੁਝ ਇਹੋ ਜਿਹੇ ਲੋਕ ਹਨ ਜਾਨੀ ਕਿ ਕੁਝ ਇਹੋ ਜਿਹੇ ਸਿੰਗਰ ਵੀ ਅੱਜ ਕੱਲ੍ਹ ਉੱਠ ਕੇ ਆ ਗਏ ਹਨ ਜਿਨਾਂ ਨੂੰ ਗਾਉਣਾ ਸੁਰ ਦਾ ਕੁਛ ਪਤਾ ਨਹੀਂ ਹੈ ਅਤੇ ਬਸ ਉਹ ਕੰਪਿਊਟਰ 'ਤੇ ਲਾ ਕੇ ਆਪਣੀ ਆਵਾਜ਼ ਆਟੋ ਟਿਊਨ ਨਾਲ ਸੁਧਾਰ ਕੇ ਅਤੇ ਗਾਈ ਜਾ ਰਹੇ ਹਨ ਪਰ ਜੋ ਵਿਅਕਤੀ ਗਾਉਣਾ ਚਾਹੁੰਦਾ ਹੈ ਉਸ ਨੂੰ ਰਿਆਜ਼ ਤਾਂ ਜ਼ਰੂਰ ਹੀ ਕਰਨਾ ਚਾਹੀਦਾ ਹੈ ਰਿਆਜ਼ ਤੋਂ ਬਗੈਰ ਉਸ ਵਿਅਕਤੀ ਨੂੰ ਗਾਉਣ ਦਾ ਹੁਨਰ ਆ ਤਾਂ ਸਕਦਾ ਹੈ ਪਰ ਉਸ ਵਿੱਚ ਸੁਧਾਰ ਕਰਨ ਲਈ ਸਭ ਤੋਂ ਜ਼ਰੂਰੀ ਹੈ ਰਿਆਜ਼ ਉਹ ਹਰ ਰੋਜ਼ ਆਪਣਾ ਰਿਆਜ਼ ਕਰੇ ਅਤੇ ਰਿਆਜ਼ ਤੋਂ ਬਾਅਦ ਉਸ ਜੋ ਵੀ ਉਸ ਨੇ ਗਾਉਣਾ ਹੈ ਉਸ ਦੀ ਅਭਿਆਸ ਵਾਰ ਵਾਰ ਕਰੇ ਤਾਂ ਜੋ ਉਹ ਅਭਿਆਸ ਵਿੱਚ ਪੱਕਾ ਹੋ ਜਾਵੇ ਅਤੇ ਉਸ ਬਾਰੇ ਉਸ ਨੂੰ ਸਭ ਕੁਛ ਪਤਾ ਹੋਵੇ ਵੀ ਕਿਹੜਾ ਸੁਰ ਕਿੱਥੇ ਲੱਗਣਾ ਹੈ ਅਤੇ ਕਿੱਥੇ ਨਹੀਂ ਲੱਗਣਾ ਧੰਨਵਾਦ ਜੀ